ਭਾਰਤ ਵਿੱਚ ਮਸ਼ਹੂਰ ਨਾਚ ਸ਼ੈਲੀ ਦਾ ਰੂਪ ਭਰਤਨਾਟਿਅਮ ਅਤੇ ਕਲਾਸੀਕਲ ਡਾਂਸ ਹੈ ਜਿਸ ਜਿਸ ਵਿੱਚ ਮੈਂ ਮਸ਼ਹੂਰ ਕਲਾਕਾਰ ਵੈਨੀ ਗਨਪਤੀ ਨੂੰ ਜਾਣਦੀ ਹਾਂ ਉਹ ਕਲਕੱਤਾ ਦੀ ਰਹਿਣ ਵਾਲੀ ਹੈ